ਹੈਲੋ ਵਧੀਆ ਤੁਸੀਂ ਸੁਣਾਓ ਮਨਮੀਤ ਮੈਮ ਕੀ ਹਾਲ ਆ ਬਹੁਤ ਵਧੀਆ ਸੀਗਾ ਸਕੂਲ ਦਾ ਜਿਹੜਾ ਫੰਕਸ਼ਨ ਸੀ ਸਾਰੀਆਂ ਐਕਟੀਵਿਟੀਜ ਬਹੁਤ ਵਧੀਆ ਸੀਗੀਆਂ ਅਸਲ ਵਿੱਚ ਜਿਹੜਾ ਨਾ ਫੰਕਸ਼ਨ ਸੀਗਾ ਉਹਨੇ ਹਰ ਇਕ ਸਟੇਟ ਦਾ ਹਰੇਕ ਮਤਲਬ ਕਲਚਰ ਨੂੰ ਨਾ ਰਿਲ ਰਿਲੇਟਡ ਸੀਗੀਆਂ ਹਾਂ ਬਿਲਕੁਲ ਜਿਹੜੀਆਂ ਬੋਲੀਆਂ ਸੀਗੀਆਂ ਉਹ ਸੱਭਿਆਚਾਰ ਨਾਲ ਰਿਲੇਟਡ ਵੀ ਸੀਗੀਆਂ ਅਤੇ ਨਾਲ ਦੇ ਨਾਲ ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਬੋਲੀਆਂ ਵੀ ਸੀਗੀਆਂ ਹਾਂਜੀ ਨਹੀਂ ਨਹੀਂ ਸਾ ਸਾਰੇ ਫੰਕਸ਼ਨ ਦੇ ਵਿੱਚ ਜਿੰਨੀਆਂ ਵੀ ਪਾਰਟੀਸਪੇਟ ਕੀਤਾ ਬੱਚਿਆਂ ਨੇ ਉਹਨਾਂ ਨੇ ਬਹੁਤ ਵਧੀਆ ਕੀਤਾ ਈਵਨ ਜਿਹੜੀ ਉਹ ਤੁਸੀਂ ਸਟਿ ਸਕਿੱਟ ਦੇਖੀ ਸੀ ਹਾਂ ਹਾਂ ਬਿਲਕੁਲ ਜਿਸ ਤਰਾਂ ਗੂਗਲ ਹੋ ਗਿਆ ਜਾਂ ਟਿਕਟੋਕ ਹੈ ਬਹੁਤ ਸਾਰੀਆਂ ਇਹ ਜਿਹੜੀਆਂ ਬੱਚਾ ਜਿਨ੍ਹਾਂ ਦਾ ਆਦੀ ਹੋ ਚੁੱਕਾ ਆ ਉਹ ਯੂਜਫੁਲ ਵੀ ਨਹੀਂ ਹ ਪਰ ਯੂਜ ਹਾਂ ਬਿਲਕੁਲ ਉਹਨਾਂ ਦੀ ਯੂਜਫੁਲ ਢੰਗ ਨਾਲ ਨਹੀਂ ਵਰਤ ਰਿਹਾ ਪਰ ਉਹ ਉਹਨਾਂ ਦਾ ਆਦੀ ਹੋ ਚੁੱਕਾ ਆ ਬਿਲਕੁਲ ਬਹੁਤ ਵਧੀਆ ਲੱਗੀ ਮੈਨੂੰ ਇਹ ਵਾਲੀ ਐਪ ਇੱਕ ਹੋਰ ਸੀ ਜਿਹਦੇ ਵਿੱਚ ਪਾਣੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਜਿਹੜੀਆਂ ਮੇਨ ਸਮੱਸਿਆਵਾਂ ਆ ਰਹੀਆਂ ਜਿੱਦਾਂ ਪਾਣੀ ਨਾਲ ਸੰਬੰਧਿਤ ਸੀਗੀਆਂ ਪੰਜਾਬ ਦੇ ਵਿੱਚ ਬਹੁਤ ਸਾਰੇ ਡੇਰੇ ਖੁੱਲ੍ਹੇ ਹੋਏ ਆ ਬਾਬੇ ਹੋਏ ਨੇ ਹੋਏ ਆ ਅਸੀਂ ਮੰਨ ਈਵਨ ਕਿ ਹਾਂ ਹਾਂਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਫੰਕਸ਼ਨ ਹਰ ਇਕ ਚੀਜ਼ ਬਹੁਤ ਵਧੀਆ ਨੋਲੇਜ ਦੇਣ ਵਾਲੀ ਸੀ ਬਿਲਕੁਲ ਬਿਲਕੁਲ ਮਤਲਬ ਹਰ ਇੱਕ ਚੀਜ਼ ਪਰਫੈਕਟ ਸੀਗੀ ਛੋਟੇ ਬੱਚਿਆਂ ਦੇ ਇਥੋਂ ਤੱਕ ਕਿ ਨਰਸਰੀ ਦੇ ਬੱਚਿਆਂ ਦਾ ਡਾਂਸ ਬਹੁਤ ਜਿਆਦਾ ਵਧੀਆ ਸੀ ਹਾਂ ਬਿਲਕੁਲ ਹਰ ਇੱਕ ਚੀਜ਼ ਪਰਫੈਕਟ ਹਾਂ ਸਪੋਰਟਸ ਦੇ ਵਿੱਚ ਜਿਹੜੇ ਸਾਡੇ ਬੱਚਿਆਂ ਨੇ ਜੋ ਮਤਲਬ ਮੈਡਲ ਪ੍ਰਾਪਤ ਕੀਤੇ ਈਵਨ ਸਾਡੇ ਬੱਚੇ ਫੋਰਨ ਖੇਡਣ ਗਏ ਹੋਏ ਸੀਗੇ ਹਾਂਜੀ ਹਾਂਜੀ ਹਰ ਇੱਕ ਇਹ ਇਹਦੇ ਨਾਲ ਪੇਰੈਂਟਸ ਨੂੰ ਵੀ ਪਤਾ ਲੱਗਦਾ ਕਿ ਹਾਂ ਸਕੂਲ ਦੇ ਵਿੱਚ ਬਹੁਤ ਸਾਰੀਆਂ ਗੇਮਾਂ ਕਰਵਾਈਆਂ ਜਾਂਦੀਆਂ ਆ ਅਤੇ ਬੱਚ ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਸੀ ਹਾਂ ਹਾਂਜੀ ਹਾਂਜੀ ਸਹੀ ਹੈ ਹੋਰ ਬੱਚਿਆਂ ਨੂੰ ਸਾਡੇ ਕਲਚਰ ਬਾਰੇ ਪਤਾ ਹੀ ਤਾਂ ਲੱਗਦਾ ਕਿਉਂਕਿ ਅੱਜ ਕੱਲ੍ਹ ਅਤੇ ਬੱਚਿਆਂ ਨੂੰ ਸਿਰਫ ਇੰਨਾ ਪਤਾ ਕਿ ਡੀ ਜੇ 'ਤੇ ਡਾਂਸ ਚੱਲ ਗਾਣੇ ਲਗਾ ਲਓ ਔਰ ਨੱਚ ਲਓ ਆਪਣੇ ਫੋਕ ਕਲਚਰ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਠੀਕ ਹ ਆਪਾਂ ਠੀਕ ਹੈ ਜੀ ਓਕੇ ਜੀ ਓਕੇ ਬਾਏ